ਹੈਲੋ ਹਾਂਜੀ ਰਮਨ ਸਿੰਘ ਜੀ ਬੋਲ ਰਹੇ ਹੋ ਜੀ ਹਾਂਜੀ ਇੱਕ ਬਾਈ ਜੀ ਸਾਨੂੰ ਨੰਬਰ ਮਿਲਿਆ ਸੀ ਕਿਸੇ ਮਿੱਤਰ ਤੋਂ ਅਤੇ ਅਸੀਂ ਇੱਕ ਮਕਾਨ ਖਰੀਦਣਾ ਗਾ ਬਣਿਆ ਬਣਾਇਆ ਜੀ ਹਾਂਜੀ ਚਾਰ ਕੁ ਵਿਸ ਚਾਰ ਕੁ ਵਿਸਵੇ 'ਚ ਹੋਵੇ ਜੀ ਅਤੇ ਸਿੰਗਲ ਪੋਰਸ਼ਨ ਹੋਵੇ ਹਾਂਜੀ ਅਤੇ ਵਧੀਆ ਇਲਾਕੇ 'ਚ ਹੋਵੇ ਜਿੱਥੇ ਨੇੜੇ ਕੋਈ ਬੱਸ ਸਟੈਂਡ ਪਵੇ ਹਾਂਜੀ ਅਤੇ ਹਾਂਜੀ ਹਾਂਜੀ ਬੱਜਟ ਲਾ ਦਾਂਗੇ ਜੀ ਵੀਹ ਬਾ ਵੀਹ ਪੱਚੀ ਲੱਖ ਇੰਸਾਇਰ ਤੋਂ ਬਾਹਰ ਜੀ ਨਵੀਂ ਕਲੋਨੀ ਕੋਈ ਹੋਵੇ ਬਣੀ ਹੋਈ ਹਾਂਜੀ ਫਾਟਕ ਦੀ ਸਮੱਸਿਆ ਨਾ ਹੋਵੇ ਜੀ ਕੋਈ ਗੱਡੀ 'ਤੇ ਆਉਣਾ ਜੀ ਫਾਟਕ ਨਾ ਹੋਵੇ ਨੇੜੇ ਲੱਗਦਾ ਕੋਈ ਕੋਈ ਆਉਣ ਜਾਣ ਵੇਲੇ ਕੰਮ 'ਤੇ ਆਈਏ ਜਾਈਏ ਲੱਗੇ ਹੀ ਪਿਆ ਰਹੇ ਹਾਂਜੀ

ਅੱਛਾ ਅੱਛਾ ਕੀ ਡਿਮਾਂਡ ਆ ਗਈ ਉੱਥੇ ਅੱਛਾ ਅੱਛਾ ਕੋਈ ਉੱਥੇ ਸੀਵਰੇਜ ਵਗੈਰਾ ਸਾਰਾ ਪਿਆ ਹੋਇਆ ਅੱਛਾ ਸਟਰੀਟ ਲਾਈਟ ਦਾ ਪ੍ਰਬੰਧ ਅੱਛਾ ਅੱਛਾ ਠੀਕ ਆ ਜੀ ਸੜਕ ਕਾਹਦੀ ਬਣੀ ਹੋਈ ਆ ਟਾਈਲਾਂ ਦੀ ਕਿ ਅੱਛਾ ਅੱਛਾ ਅੱਛਾ ਵੀਹ ਫੁੱਟ ਗਲੀ ਆ ਠੀਕ ਆ ਜੀ ਅੱਛਾ ਅੱਛਾ ਅੱਛਾ

ਅੱਛਾ ਅੱਛਾ ਅੱਛਾ ਆਪ ਬਣਾਇਆ ਹੋਇਆ ਇਹਨਾਂ ਦਾ

ਠੀਕ ਹੈ ਅਸੀਂ ਆਉਂਦੇ ਹਾਂ ਫਿਰ ਤੁਹਾਡੇ ਨਾਲ ਆ ਕੇ ਗੱਲ ਕਰਦੇ ਹਾਂ ਜੀ ਠੀਕ ਆ ਨਾਲੇ ਮਕਾਨ ਦੇਖ ਲਾਂਗੇ ਠੀਕ ਠੀਕ ਠੀਕ ਆ ਜੀ ਅਸੀਂ ਫੋਨ ਕਰਕੇ ਆਉਂਦੇ ਹਾਂ ਜੀ ਅਸੀਂ ਤੁਹਾਨੂੰ ਫੋਨ ਕਰਦੇ ਹਾਂ ਅਸੀਂ ਆਵਾਂਗੇ ਓਕੇ

ਠੀਕ ਆ ਠੀਕ ਆ ਜੀ ਓਕੇ ਓਕੇ ਜੀ ਓਕੇ ਓਕੇ ਓਕੇ ਓਕੇ